ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਸਾਨੂੰ ਕੁਝ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿ ਪਾਣੀ ਡੂੰਘਾ ਹੈ ਜਾਂ ਘੱਟ ਡੂੰਘਾ ਪਾਣੀ ਦੇ ਹੇਠਾਂ ਲੱਕੜਾਂ ਜਾਂ ਵੱਡੀਆਂ ਚੱਟਾਨਾਂ ਸਾਰੀਆਂ ਹੀ ਖਤਰਨਾਕ ਹਨ ਜਦੋਂ ਅਸੀਂ ਝੀਲਾਂ ਜਾਂ ਤੈਰਨ ਵਾਲੇ ਸੁਰਾਖਾਂ ਵਿੱਚ ਚੁੱਭੀਆਂ ਮਾਰਦੇ ਹਾਂ ਤਾਂ ਗੰਭੀਰ ਸੱਟ ਲੱਗ ਸਕਦੀ ਹੈ ਜਦੋਂ ਪੂਲ ਜਾਂ ਹੋਰ ਤੈਰਾਕੀ ਇਲਾਕੇ ਵਿੱਚ ਹੋਈਏ ਤਾਂ ਸਾਨੂੰ ਸਿਰਫ਼ ਉਹਨਾਂ ਖੇਤਰਾਂ ਵਿੱਚ ਚੁੱਭੀ ਲਗਾਉਣੀ ਚਾਹੀਦੀ ਹੈ ਜਿੱਥੇ ਡਾਈਵ ਕਰਨਾ ਸੁਰੱਖਿਅਤ ਹੋਵੇ ਹਮੇਸ਼ਾ ਆਪਣੇ ਆਲੇ ਦੁਆਲੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਪਹਿਲਾਂ ਆਪਣੇ ਪੈਰਾਂ ਨੂੰ ਪਾ ਕੇ ਪਾਣੀ ਵਿੱਚ ਹੌਲੀ ਹੌਲੀ ਵੜਨਾ ਚਾਹੀਦਾ ਹੈ ਪਾਣੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਰ ਵਾਰ ਖੇਤਰ ਨੂੰ ਜਾਂਚਣਾ ਚਾਹੀਦਾ ਹੈ ਕਿਉਂਕਿ ਤੈਰਾਕੀ ਹਾਲਾਤ ਜਾਂ ਮਾਹੌਲ ਬਦਲ ਸਕਦਾ ਹੈ ਜਦੋਂ ਪਾਣੀ ਵਿੱਚ ਵੜਦਿਆਂ ਸਾਨੂੰ ਉੱਥੇ ਹੀ ਤੈਰਨਾ ਚਾਹੀਦਾ ਹੈ ਜਿੱਥੇ ਅਸੀਂ ਸੁਖਾਵਾਂ ਮਹਿਸੂਸ ਕਰੀਏ ਸਾਨੂੰ ਜਿੰਨਾ ਹੋ ਸਕੇ ਉੰਨਾ ਅੱਗੇ ਜਾਂ ਡੂੰਘੇ ਨਹੀਂ ਜਾਣਾ ਚਾਹੀਦਾ ਰੱਸੀ ਦੇ ਅੰਦਰ ਵਾਲੇ ਖੇਤਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਸਾਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਜੇ ਪੂਲ ਦੀ ਨਾਲੀ ਦਾ ਢੱਕਣ ਨਹੀਂ ਹੈ ਤਾਂ ਪੂਲ ਵਿੱਚ ਨਹੀਂ ਵੜਨਾ ਚਾਹੀਦਾ ਜਦੋਂ ਤੱਕ ਕਿ ਢੱਕਣ ਬਦਲਿਆ ਨਹੀਂ ਜਾਂਦਾ ਝੀਲਾਂ ਨਦੀਆਂ ਅਤੇ ਸਮੁੰਦਰਾਂ ਵਿੱਚ ਐਲਗੀ ਦੇ ਬਲੂਮ ਹੁੰਦੇ ਹਨ ਜਿਸ ਨਾਲ ਤੈਰਾਕੀ ਕਰਨ ਵਾਲਿਆਂ ਲਈ ਤਿਲਕਣ ਹੋ ਜਾਂਦੀ ਹੈ ਇਸ ਤਰ੍ਹਾਂ ਸਾਨੂੰ ਤੈਰਾਕੀ ਕਰਦਿਆਂ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿ ਪੂਲ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਪੂਲ ਵਿੱਚ ਕੋਈ ਗੰਦਗੀ ਨਹੀਂ ਹੋਣੀ ਚਾਹੀਦੀ ਜਿਸ ਨਾਲ ਸਾਨੂੰ ਘੱਟ ਮਹਿਸੂਸ ਹੋਵੇ